ਮੈਨੂੰ ਸੋਸ਼ਲ ਮੀਡੀਆ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ ਮੈਂ ਜਿੰਨੀਆਂ ਵੀ ਤਸਵੀਰਾਂ ਲੈਂਦੀ ਹਾਂ ਮੈਂ ਆਪਣੇ ਫੋਨ 'ਚ ਹੀ ਰੱਖਦੀ ਹਾਂ ਜਾਂ ਆਪਣੇ ਲੈਪਟੋਪ 'ਚ ਅਤੇ ਆਪਣੇ ਦੋਸਤਾਂ ਨਾਲ ਉਹਨਾਂ ਨੂੰ ਸ਼ੇਅਰ ਕਰ ਲੈਂਦੀ ਹਾਂ ਪਰ ਮੈਂ ਸੋਸ਼ਲ ਮੀਡੀਆ 'ਤੇ ਜ਼ਿਆਦਾ ਪੋਸਟ ਨਹੀਂ ਕਰਦੀ ਅਤੇ ਨਾ ਮੈਨੂੰ ਉਹਨਾਂ ਦੇ ਰੂਲਸ ਬਾਰੇ ਜ਼ਿਆਦਾ ਜਾਣਕਾਰੀ ਹੈ